ਹਾਂ ਇਹ ਠੀਕ ਹੈ ਕਿ ਨਿਊਜ਼ ਮੀਡੀਆ ਜਿਹੜੀ ਹੈਗੀ ਨਾ ਪੇਂਡੂ ਖੇਤਰਾਂ ਦੇ ਕਾਫੀ ਮੁੱਦੇ ਦਿਖਾਉਂਦੇ ਹਨ ਜਿਸ ਤਰ੍ਹਾਂ ਕਿ ਨਹਿਰਾਂ ਦਾ ਨਹਿਰਾਂ ਦਾ ਮੁੱਦਾ ਕੋਈ ਖੇਤੀਬਾੜੀ ਦਾ ਕੋਈ ਫ਼ਸਲਾਂ ਦਾ ਵੀ ਨਹਿਰਾਂ ਦਾ ਪਾਣੀ ਦੇ ਵਿੱਚ ਕੋਈ ਅਗਰ ਪ੍ਰੋਬਲਮ ਆਉਂਦੀ ਹੈ ਪਾਣੀ ਸਪਲਾਈ ਨਹੀਂ ਮਿਲਦਾ ਤਾਂ ਉਹ ਉਹ ਵੀ ਉਹ ਖਾਂਦੀਆਂ ਖੇਤੀਬਾੜੀ ਵਿੱਚ ਵੀ ਕਿਹੜੀ ਫ਼ਸਲ 'ਤੇ ਵਾਧਾ ਘਾਟਾ ਹੋ ਰਿਹਾ ਜਾਂ ਤਾਂ ਫਸਲਾਂ ਬਾਰੇ ਵੀ ਹੁਣ ਉਹ ਅੱਜ ਕੱਲ੍ਹ ਮੁੱਦਾ ਚੱਲ ਰਿਹਾ ਕਿਸਾਨਾਂ ਦਾ ਕਿਸਾਨ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ ਇਹ ਮੁੱਦਾ ਵੀ ਨਿਊਜ਼ ਨਿਊਜ਼ ਮੀਡੀਆ 'ਤੇ ਬਿਲਕੁਲ ਦਿਖਾਇਆ ਜਾਂਦਾ ਹੈ ਪਿੱਛੇ ਇੱਕ ਕਿਸਾਨ ਨੂੰ ਵੀ ਗੋਲੀ ਲੱਗੀ ਸੀ ਇਹ ਮੁੱਦਾ ਉਹ ਸਾਰਾ ਸ਼ੋਅ ਕਰਦੇ ਹਨ ਸਾਰਾ ਦੱਸਦੇ ਹਨ ਅਤੇ ਕਈ ਮੁੱਦੇ ਐਸੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਿਊਜ਼ ਮੀਡੀਆ ਦਿਖਾਉਣਾ ਚਾਹੁੰਦਾ ਹੈ ਪਰ ਪਿੱਛੋਂ ਦਬਾਅ ਪੈਣ ਕਾਰਨ ਜਾਂ ਸਿਆਸੀ ਪਾਰਟੀਆਂ ਦਬਾਅ ਕਰਨ ਉਹ ਉਹ ਨਿਊਜ਼ ਮੀਡੀਆ ਨੂੰ ਨਿਊਜ਼ ਨੂੰ ਵਿੱਚੇ ਬੰਦ ਕਰ ਦਿੰਦੇ ਜਾਂ ਦਿਖਾਉਂਦਾ ਹੀ ਨਾ ਉੱਤੋਂ ਦਬਾਅ ਪਾਉਂਦੇ ਹਨ ਵੀ ਤੁਸੀਂ ਇਹ ਚੀਜ਼ ਨਹੀਂ ਦਿਖਾਉਣੀ ਅਗਰ ਤੁਸੀਂ ਦਿਖਾਓਗੇ ਤਾਂ ਅਸੀਂ ਤੁਹਾਡਾ ਚੈਨਲ ਸੀਜ਼ ਕਰ ਦਿਆਂਗੇ ਇਸ ਕਰੇ ਕੁਛ ਕਈ ਮੁੱਦੇ ਦਿਖਾਏ ਜਾਂਦੇ ਹਨ ਅਤੇ ਕਈ ਮੁੱਦੇ ਨਹੀਂ ਵੀ ਦਿਖਾਏ ਜਾਂਦੇ ਹਨ ਚਲੋ ਅੱਜ ਕੱਲ੍ਹ ਦੇ ਵਿੱਚ ਵੀ ਤਾਂ ਨਿਊਜ਼ ਮੀਡੀਆ ਦਾ ਬੜਾ ਆਮ ਇਹ ਤਾਂ ਹਰ ਇੱਕ ਚੀਜ਼ ਨੂੰ ਬੜਾ ਉਹ ਉਹ ਉੱਚੇ ਲੈ ਜਾਂਦਾ ਹੈ ਛੋਟੀ ਜਿਹੀ ਗੱਲ ਨੂੰ ਵੱਡਾ ਵੀ ਦਿਖਾ ਦਿੰਦਾ ਅਤੇ ਕਈ ਵਾਰੀ ਵੱਡੀ ਗੱਲ ਨੂੰ ਛੋਟਾ ਵੀ ਕਰ ਸਕਦਾ ਇਹ ਤਾਂ ਉਹਨਾਂ 'ਤੇ ਡਿਪੈਂਡ ਕਰਦਾ ਹੈ ਮਿਹਰਬਾਨੀ